ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਸਰ ਮੈਂ ਸਟੂਡੈਂਟ ਬੋਲ ਰਿਹਾ ਸੀਗਾ ਟੈਂਨਥ ਕਲਾਸ ਦਾ ਆਨੰਦ ਸਕੂਲ ਤੋਂ ਹਾਂਜੀ ਸਰ ਤੁਸੀਂ ਆਨੰਦ ਸਕੂਲ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਮੇਰਾ ਨਾਂ ਅਨੀਕੇਤ ਸੀ ਮੈਂ ਟੈਂਨਥ ਕਲਾਸ 'ਚ ਪੜ੍ਹਦਾ ਟੈਂਨਥ ਕਲਾਸ 'ਚ ਪੜ੍ਹਦਾ ਵਾਂ ਹਾਂਜੀ ਸਰ ਮੇਰੀ ਥੋੜ੍ਹੀ ਕੁਝ ਪ੍ਰੋਬਲਮ ਪੈ ਗਈ ਸੀਗੀ ਅਤੇ ਜਿਸ ਕਰਕੇ ਮੈਂ ਥੋੜ੍ਹਾ ਲੀਵ ਮੰਗਣੀ ਸੀਗੀ ਹਾਂ ਸਰ ਇਸ਼ੂ ਇਹ ਆ ਰਹੇ ਸੀ ਮੇਰਾ ਥੋੜ੍ਹਾ ਫੀਵਰ ਹੋ ਗਿਆ ਸੀਗਾ ਕੁਛ ਦਿਨ ਪਹਿਲਾਂ ਅਤੇ ਮੈਂ ਥੋੜ੍ਹਾ ਡੋਕਟਰ ਕੋਲ ਗਿਆ ਸੀ ਇਲਾਜ ਉਹਨਾਂ ਨੂੰ ਕਰਵਾਇਆ ਸੀਗਾ ਅਤੇ ਉਹਨਾਂ ਨੇ ਮੈਨੂੰ ਥੋੜ੍ਹੀ ਮੈਡੀਸਨ ਵਗੈਰਾ ਅਤੇ ਪ੍ਰੋਪਰ ਰੈਸਟ ਵਗੈਰਾ ਕਰਨ ਨੂੰ ਦਿੱਤੀ ਆ ਸਰ ਉਹਨਾਂ ਨੇ ਟੈਂਨ ਡੇ ਮਤਲਬ ਦਸ ਦਿਨ ਤੱਕ ਉਹਨਾਂ ਨੇ ਕਿਹਾ ਕਿ ਤੁਸੀਂ ਰੈਸਟ ਪ੍ਰੋਪਰ ਕਰੋ ਅਤੇ ਥੋੜ੍ਹਾ ਰਿਕਵਰ ਹੋ ਕੇ ਫਿਰ ਕੋ ਮਤਲਬ ਸਕੂਲ ਵਗੈਰਾ ਜਾਣਾ ਹਾਂਜੀ ਹਾਂਜੀ ਸਰ ਇਹੀ ਥੋੜ੍ਹੀ ਗਾਈਡੈਂਸ ਲੈਣੀ ਸੀਗੀ ਤੁਹਾਡੇ ਤੋਂ ਮਤਲਬ ਮੈਂ ਇਸ ਚੀਜ਼ ਬਾਰੇ ਮਤਲਬ ਰਿਕਵਰ ਕਿੱਦਾਂ ਮਤਲਬ ਰਿਕਵਰ ਕਿੱਦਾਂ ਕਰਾਂ ਆਪਣੀ ਪੜ੍ਹਾਈ ਨੂੰ ਕਿ ਨੁਕਸਾਨ ਨਾ ਹੋ ਮੇਰਾ ਯੈਸ ਸਰ ਹਾਂਜੀ ਸਰ ਹਾਂਜੀ ਸਰ ਯੈਸ ਸਰ ਹਾਂਜੀ ਸਰ

ਯੈਸ ਸਰ

ਹਾਂਜੀ ਠੀਕ ਆ ਸਰ ਸਰ ਕੋਈ ਨਹੀਂ ਸਰ ਕੋਈ ਨਹੀਂ ਮੈਂ ਤੁਹਾਨੂੰ ਆਪਣੀ ਫਾਈਲ ਵਗੈਰਾ ਭੇਜ ਦੂਆਂਗਾ ਅਤੇ ਮੈਂ ਤੁਸੀਂ ਪ੍ਰੋਵਾਈਡ ਕਰਵਾ ਦੇਣਾ ਮੈਂ ਕਲਾਸ ਵਗੈਰਾ ਲਾ ਲਵਾਂਗਾ ਔਨਲਾਈਨ ਠੀਕ ਹੈ ਥੈਂਕ ਯੂ ਸਰ